ਪੰਜਾਬ ਵਿੱਚ ਖੇਡ ਖੇਤਰ ਦਾ ਲਿੰਗ ਸਮਾਨਤਾ ਜਿੱਦਾਂ ਇਹ ਸਰਕਾਰ ਅਕੈਡਮੀ ਚਲਾਉਂਦੀ ਜਿੱਦਾਂ ਅਕੈ ਅਕੈਡਮੀ ਵਿੱਚ ਅਤੇ ਲਿੰਗ ਕੁੜੀਆਂ ਮੁੰਡਿਆਂ ਨੂੰ ਦੋਵਾਂ ਨੂੰ ਵੀ ਖੇਡਣ ਮੌ ਖੇਡਣ ਦਾ ਮੌਕਾ ਦਿੰਦੀ ਆ ਦੋਵਾਂ ਵਾਸਤੇ ਕ ਦੋਵਾਂ ਵਾਸਤੇ ਅਕੈਡਮੀ ਬਣਾਈ ਉਹਨਾਂ ਨੇ ਦੋਵਾਂ ਵਾਸਤੇ ਅਕੈਡਮੀ ਬਣਾਈ ਏ ਦੋਹੀ ਦੋਵਾਂ ਨੂੰ ਅਤੇ ਪੂਰੀ ਸਮਾਨਤਾ ਮਿਲਦੀ ਏ ਪੂਰੀ ਵਧੀਆ ਤਰੀਕੇ ਨਾਲ ਅੱਗੇ ਵਧਣ ਦਾ ਮੌਕਾ ਮਿਲਦਾ ਸਰਕਾਰ ਸਾਰਿਆਂ ਨੂੰ ਅੱਗੇ ਵਧਣ ਦਾ ਮੌਕਾ ਦਿੰਦੀ ਏ ਵਿੱਚੇ ਕੁੜੀਆਂ ਨੂੰ ਵਿੱਚੇ ਮੁੰਡਿਆਂ ਨੂੰ ਦੋਵਾਂ ਨੂੰ ਮਿਲਣ ਦਾ ਅੱਗੇ ਵਧਣ ਦਾ ਮੌਕਾ ਮਿਲਦਾ